ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਹਾਂਜੀ ਬਸ ਠੀਕ ਆ ਸਾਡਾ ਵੀ ਹਾਂਜੀ ਹਾਂਜੀ ਬਸ ਹੁਣ ਮੈਰਿਜ ਹੈ ਆ ਵਿਆਹ ਕਰਨਾ ਅਗਲੇ ਮਹੀਨੇ ਆਪਣੇ ਦੇਰ ਦਾ ਤਾਂ ਕਰਕੇ ਹੁਣ ਕਾਫੀ ਜ਼ਿਆਦਾ ਹਾਂਜੀ ਰੁੱਝੇ ਹੋਏ ਹਾਂ ਰੁਝੇਵੇਂ ਬਹੁਤ ਜ਼ਿਆਦਾ ਹੋਰ ਤੁਹਾਨੂੰ ਵੀ ਹੋਰ ਕੀ ਅਤੇ ਹਾਂਜੀ ਹਾਂਜੀ ਇੱਧਰ ਹੋਰ ਹਾਂਜੀ ਹਾਂਜੀ ਉਹੀ ਮੈਂ ਸੋਚਿਆ ਤਾਂ ਸੀਗਾ ਕਿ ਤੁਹਾਡੇ ਘਰ ਵੱਲਾ ਚੱਕਰ ਮਾਰਾਂਗੇ ਅੱਜ ਗਏ ਸੀ ਮਾਰਕੀਟ ਅਤੇ ਬਾਜ਼ਾਰ ਦੇ ਵਿੱਚ ਹੀ ਉੱਥੇ ਟ੍ਰੈਫਿਕ ਇੰਨਾ ਜ਼ਿਆਦਾ ਰਸਤੇ 'ਚ ਹੀ ਸਾਨੂੰ ਬਹੁਤ ਟਾਈਮ ਲੱਗ ਗਿਆ ਹੁਣ ਵੀ ਸਵੇਰ ਦੇ ਗਏ ਹੋਏ ਸੀਗੇ ਅਤੇ ਹੁਣੀ ਘਰ ਵੜੇ ਹਾਂ ਅਸੀਂ ਅਤੇ ਪਹਿਲਾਂ ਰਸਤੇ ਵਿੱਚ ਉੱਥੇ ਜਾ ਜਾਮ ਲੱਗਾ ਹੋਇਆ ਸੀਗਾ ਉਹਦੇ ਕਰਕੇ ਕਿੰਨਾ ਟਾਈਮ ਉੱਥੇ ਲੱਗ ਗਿਆ ਸਾਨੂੰ ਫਿਰ ਹਾਂਜੀ ਕਦੇ ਲਾਈਟਾਂ 'ਚ ਟ੍ਰੈਫਿਕ ਲਾਈਟਾਂ 'ਤੇ ਰੁਕੋ ਕਦੇ ਫਿਰ ਕਿਤੇ ਇੰਨਾ ਜ਼ਿਆਦਾ ਟ੍ਰੈਫਿਕ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਹੈ ਨਾ ਤਾਂ ਹਾਂਜੀ ਹਾਂ ਹਾਂਜੀ ਹਾਂਜੀ ਉਹੀ ਹੁਣ ਉਦਾਂ ਦੀ ਹਾਂਜੀ ਹਾਂ ਉਹੀ ਤਾਂ ਕਾਰਾਂ ਦਾ ਇੰਨਾ ਜ਼ਿਆਦਾ ਰਸ਼ ਪੈ ਜਾਂਦਾ ਕਾਰਾਂ ਤਾਂ ਲੰਘਣ ਦਿੰਦੀਆਂ ਹੀ ਨਹੀਂ ਅਤੇ ਦੂਸਰਾ ਸਕੂਟਰਾਂ ਵਾਲੇ ਮੋਟਰਸਾਈਕਲਾਂ ਵਾਲੇ ਹਾਂਜੀ ਹਾਂਜੀ ਉਹੀ ਤਾਂ ਸ਼ੋਪਿੰਗ ਰੋਜ਼ ਹੁਣ ਜਾਣਾ ਪੈਂਦਾ ਬਾਜ਼ਾਰ ਕਦੇ ਕੋਈ ਸਮਾਨ ਕਦੇ ਕੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਹਾਂਜੀ ਉਹੀ ਨਾ ਪੰਦਰਾਂ ਮਿਨਟ ਜੇ ਹੋਰ ਪੰਦਰਾਂ ਮਿਨਟ ਦੇ ਵਿੱਚ ਜਿਹੜੀ ਦੂਰੀ ਕਵਰ ਕਰਨੀ ਹੁੰਦੀ ਹੈ ਉਹਨੂੰ ਪੂਰਾ ਢਾਈ ਘੰਟੇ ਲੱਗ ਜਾਂਦੇ ਹੈ ਅਤੇ ਟ੍ਰੈਫਿਕ ਕਰਕੇ ਹਾਂਜੀ ਹਾਂਜੀ ਹਾਂਜੀ ਅਤੇ ਦੂਸਰੀ ਗੱਲ ਇਹ ਆ ਕਿ ਚਲੋ ਟ੍ਰੈਫਿਕ ਤਾਂ ਹੋਏਗੀ ਆ ਦੂਸਰਾ ਆਪਣੀ ਜਿਹੜੀ ਸਰਕਾਰ ਦੀਆਂ ਪੋਲਿਸੀਜ਼ ਆ ਉਹਦੇ ਹਿਸਾਬ ਨਾਲ ਜਿਹੜਾ ਰੋਡ ਆ ਉਹ ਪਤਾ ਨਹੀਂ ਉੱਪਰੋਂ ਦੀ ਪੁੱਲ ਤਾਂ ਬਣਾਈ ਜਾ ਰਹੇ ਆ ਹਾਂਜੀ ਉਹੀ ਨਾ ਰੋਡ ਬਣਾਈ ਤਾਂ ਹਾਂ ਹਾਂ ਉਹੀ ਤਾਂ ਹਾਂਜੀ ਹਾਂਜੀ ਉਹ ਹੁਣ ਫਲਾਈ ਓਵਰ ਰਾਮਾ ਮੰਡੀ ਵੀ ਬਣਿਆ ਹੋਇਆ ਪਰ ਰਸ਼ ਤਾਂ ਉੱਥੇ ਇੰਨਾ ਜ਼ਿਆਦਾ ਹੁੰਦਾ ਕਿ ਉਹ ਉੱਥੋਂ ਤਾਂ ਨਿਕਲ ਹੀ ਨਹੀਂ ਹੁੰਦਾ ਹਾਂਜੀ ਹਾਂ ਲੰਘ ਜਾਣਾ ਉਹਨਾਂ ਦੀ ਬਹੁਤ ਮੁਸ਼ਕਿਲ ਆ ਰਹੀ ਆ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਜਾਣਾ ਹੀ ਪੈਂਦਾ ਹਾਂਜੀ ਹਾਂਜੀ ਸ਼ਹਿਰ ਤਾਂ ਜਾਣਾ ਹੀ ਪੈਣਾ ਹਾਂਜੀ ਹਾਂ ਟਾਈਮ ਤਾਂ ਵੈਸਟ ਹੋਏ ਜਾਂਦਾ ਹੁਣ ਇੰਨਾ ਕੁ ਵੀਜ਼ੀ ਹੈਗੇ ਹਾਂ ਕੋਈ ਨਹੀਂ ਟਾਈਮ ਕੱਢਾਂਗੇ ਅਸੀਂ ਹੁਣ ਗੇੜਾ ਮਾਰਾਂਗੇ ਤੁਹਾਡੇ ਵੱਲ ਅਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਆਵਾਂਗੇ ਹਾਂਜੀ ਬਸ ਸ਼ੋਪਿੰਗ ਚੱਲ ਰਹੀ ਆ ਹਾਲੇ ਖਰੀਦਦਾਰੀ ਹਾਲੇ ਅੱਧ 'ਚ ਪਹੁੰਚੀ ਆ ਹੁਣ ਘਰ ਦੀਆਂ ਤਿਆਰੀਆਂ ਤਾਂ ਹੋ ਗਈਆਂ ਹੈ ਬਾਕੀ ਹੁਣ ਆਪਣਾ ਹੀ ਸਮਾਨ ਰਹਿੰਦਾ ਹੈ ਖਰੀਦ ਖਰੀਦਣ ਖਰੂਦਣ ਵਾਲਾ ਹਾਂਜੀ ਅਤੇ ਬੱਸਾਂ 'ਚ ਵੀ ਜਾਣ ਲੱਗੇ ਹਾਂਜੀ ਹਾਂਜੀ ਭਰੇ ਜਾਂਦੇ ਹਾਂਜੀ ਰਸ਼ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਉਹੀ ਤਾਂ ਹੁਣ ਸਾਰਿਆਂ ਨੂੰ ਸ਼ੌਂਕ ਹੈਗੇ ਆ ਕਾਰਾਂ 'ਚ ਅਸੀਂ ਬੈਠ ਕੇ ਜਾਈਏ ਸਾਰਿਆਂ ਨੂੰ ਅਤੇ ਹਾਂ ਹਾਂ ਵਰਤ ਰਹੇ ਆ ਪਬਲਿਕ ਟਰਾਂਸਪੋਟ ਤਾਂ ਕੋਈ ਵਰਤ ਕੇ ਰਾਜ਼ੀ ਨਹੀਂ ਹੈਗਾ ਜਿਹੜਾ ਆ ਆਵਾਜ਼ਾਂ ਹਾਂਜੀ ਹਾਂਜੀ

ਹਾਂਜੀ ਹਾਂਜੀ ਉਹੀ ਤਾਂ ਬੱਸਾਂ ਜਿਹੜੀਆਂ ਆ ਉਹ ਉਹ ਵੀ ਤਾਂ ਬੱਸਾਂ ਹੋ ਗਈਆਂ ਜਾਂ ਆਟੋ ਰਿਕਸ਼ਾ ਹੋ ਗਏ ਤਾਂ ਉਹਨਾਂ ਦੀਆਂ ਹਾਂਜੀ ਹਾਂਜੀ ਜਾਣਾ ਹਾਂਜੀ ਹਾਂਜੀ ਸਾਰੇ ਹੀ ਜਾਂਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਦੂਜਾ ਇਹ ਗੱਲ ਇਹ ਆ ਕਿ ਸੜਕਾਂ ਹਾਂਜੀ ਹਾਂ ਸੜਕਾਂ ਦਾ ਹੈਗਾ ਵੀ ਬੁਰਾ ਹਾਲ ਹੈ ਆ ਨਾ ਸੜਕਾਂ ਵੀ ਹਾਂਜੀ ਹਾਂਜੀ ਹਾਂਜੀ ਉਹਦੇ ਕਰਕੇ ਵੀ ਉੱਥੇ ਆ ਜਾਂਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਓਕੇ ਜੀ ਓਕੇ